ਸਾਡੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਸਾਰੇ ਹੀ ਮੌਸਮ ਪੈਂਦੇ ਨੇ ਸਰਦੀ ਗਰਮੀ ਬਸੰਤ ਰੁੱਤ ਸਾਰੇ ਹੀ ਮੌਸਮ ਦਾ ਅਸੀਂ ਮਾਣ ਮਾਣਦੇ ਹਾਂ ਅਤੇ ਭਾਵੇਂ ਸਰਦੀ ਹੋਵੇ ਭਾਵੇਂ ਠੰਡ ਹੋਵੇ ਸਾਡੇ ਪੰਜਾਬ ਦੇ ਵਿੱਚ ਉਹ ਅੱਤ ਦੀ ਪੈਂਦੀ ਆ ਜਿਵੇਂ ਅੱਤ ਗਰਮੀ ਨੂੰ ਦੂਰ ਕਰਨ ਲਈ ਅਸੀਂ ਲੱਸੀ ਨਿੰਬੂ ਛਾਜ ਜਲ ਜ਼ੀਰਾ ਆਦਿ ਬਣਾਉਂਦੇ ਹਾਂ ਅਤੇ ਦੂਜੀ ਤਰਫ਼ ਸਾਡੇ ਪੰਜਾਬ ਦੇ ਵਿੱਚ ਠੰਡ ਵੀ ਬੜੀ ਅੱਤ ਦੀ ਪੈਂਦੀ ਆ ਅਤੇ ਉਸ ਵੇਲੇ ਅਸੀਂ ਚਾਹ ਦੁੱਧ ਕੌਫ਼ੀ ਆਦਿ ਬਣਾਉਣਾ ਪ੍ਰੈਫਰ ਕਰਦੇ ਹਾਂ ਅਤੇ ਚਾਹ ਤਾਂ ਸਾਡੇ ਪੰਜਾਬੀਆਂ ਦੀ ਬੜੀ ਸ਼ੌਕੀਨ ਮੰਨੀ ਜਾਂਦੀ ਆ ਅਸੀਂ ਪੰਜਾਬੀ ਚਾਹ ਦੇ ਬੜੇ ਸ਼ੌਕੀਨ ਹੁੰਦੇ ਹਾਂ ਅਤੇ ਅਸੀਂ ਕੌਫ਼ੀ ਵੀ ਬਣਾਉਦੇ ਹਾਂ ਬਟ ਮੈਨੂੰ ਲੱਗਦਾ ਕੌਫ਼ੀ ਦੋ ਤਿੰਨ ਜਾਣਿਆਂ ਲਈ ਹੀ ਪ੍ਰੈਫਰ ਕਰਦੇ ਹਾਂ ਕੌਫ਼ੀ ਦਾ ਸ਼ੌਕੀਨ ਇੰਨੇ ਨਹੀਂ ਹੋਣਗੇ ਪਰ ਸਾਡੇ ਪੰਜਾਬ ਦੇ ਵਿੱਚ ਚਾਹ ਦੇ ਲੋਕ ਬਹੁਤ ਸ਼ੌਕੀਨ ਨੇ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਅਤੇ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਅਸੀਂ ਚਾਹ ਦੇ ਇੰਨੇ ਜ਼ਿਆਦਾ ਸ਼ੌਕੀਨ ਹਾਂ ਕਿ ਸਾਨੂੰ ਚਾਹ ਚਾਹੀਦੀ ਹੀ ਚਾਹੀਦੀ ਆ ਜਿਵੇਂ ਸਾਨੂੰ ਚਾਹ ਦਾ ਨਸ਼ਾ ਹੋਵੇ ਅਤੇ ਸਾਡੇ ਪੰਜਾਬੀਆਂ ਨੂੰ ਕਿਹਾ ਵੀ ਜਾਂਦਾ ਕਿ ਚਾਹ ਦੇ ਨਸ਼ੇੜੀ